ਮੇਰਾ ਮਨਪਸੰਦ ਮੌਸਮ ਬਰਸਾਤ ਦਾ ਹੈ ਜਦੋਂ ਬਰਸਾਤ ਹੁੰਦੀ ਹੈ ਤਾਂ ਸਾਰੇ ਚਾਰੇ ਪਾਸੇ ਹੀ ਰੋਣਕਾਂ ਰੋਣਕਾਂ ਖੁਸ਼ਹਾਲੀ ਹੁੰਦੀ ਹੈ ਅਤੇ ਹਰਿਆਲੀ ਹੁੰਦੀ ਹੈ ਪੰਛੀ ਬਹੁਤ ਹੀ ਸਾਰੇ ਅਵਾਜ਼ਾਂ ਦਿੰਦੇ ਹਨ ਮੈਨੂੰ ਇਹ ਮੌਸਮ ਬਹੁਤ ਹੀ ਵਧੀਆ ਲੱਗਦਾ ਹੈ ਇਸ ਮੌਸਮ ਵਿੱਚ ਅਸੀਂ ਘਰ ਆਪਣੇ ਬ੍ਰੈਡ ਚਾਹ ਪਕੌੜੇ ਸਮੋਸੇ ਵੀ ਬਣਾਉਂਦੇ ਹਨ ਜੋ ਕਿ ਮੈਨੂੰ ਬਹੁਤ ਹੀ ਸੁਆਦ ਲੱਗਦੇ ਹਨ ਇਸ ਮੌਸਮ ਵਿੱਚ ਖਾਣ ਲਈ ਅਤੇ ਮੈਨੂੰ ਇਹ ਮੌਸਮ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਮੌਸਮ ਵਿੱਚ ਮੈਂ ਬਹੁਤ ਹੀ ਅਨੰਦ ਮਾਣਦਾ ਹਾਂ ਇਸ ਮੌਸਮ ਵਿੱਚ ਮੈਂ ਬਹੁਤ ਹੀ ਨਹਾ ਨਹਾਂਦਾ ਵੀ ਹਾਂ ਅਤੇ ਮੈਨੂੰ ਮੌ ਇਸ ਮੌਸਮ ਤੋਂ ਬਾਅਦ ਜਦੋਂ ਸਤਰੰਗੀ ਪੀਂਘ ਚੜ੍ਹਦੀ ਹੈ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਮੈਨੂੰ ਬਹੁਤ ਹੀ ਸੋਹਣੀ ਲੱਗਦੀ ਹੈ ਉਹ ਪੀਂਘ ਇਸ ਕਰਕੇ ਮੈਂ ਉਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹਾਂ ਪੀਂਘ ਨੂੰ ਪੀਂਘ ਵਿੱਚ ਬਹੁਤ ਹੀ ਸੱਤ ਕਲਰ ਹੁੰਦੇ ਹਨ ਮੈਨੂੰ ਬਹੁਤ ਹੀ ਪਸੰਦ ਹੈ ਪੀਂਘ ਇਸ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਇਹ ਮੌਸਮ ਬਰਸਾਤ ਦਾ ਵਧੀਆ ਲੱਗਦਾ ਹੈ ਇਹ ਬਰਸਾਤ ਦੇ ਮੌਸਮ ਵਿੱਚ ਅਸੀਂ ਆਪਣੇ ਘਰ ਪੀਂਘ ਵੀ ਪਾਉਂਦੇ ਹਾਂ ਝੂਲੇ ਵੀ ਲੈਂਦੇ ਹਾਂ ਅਤੇ ਨਹਾਉਂਦੇ ਵੀ ਹਾਂ ਬਹੁਤ ਹੀ ਜ਼ਿਆਦਾ ਅਨੰਦ ਕਰਦੇ ਹਾਂ ਬਰਸਾਤ ਦਾ ਮੌਸਮ ਇਹ ਇੱਦਾਂ ਦਾ ਮੌਸਮ ਹੈ ਕਿ ਸਾਰੇ ਪਾਸੇ ਹੀ ਰੌਣਕਾਂ ਰੌਣਕਾਂ ਹੋ ਜਾਂਦੀਆਂ ਹਨ ਹਰਿਆਲੀ ਹੋ ਜਾਂਦੀ ਹੈ ਖੁਸ਼ਹਾਲੀ ਹੋ ਜਾਂਦੀ ਹੈ ਇਸ ਕਰਕੇ ਬਹੁਤ ਹੀ ਪਸੰਦ ਕਰਦਾ ਇਸ ਮੌਸਮ ਨੂੰ ਮੈਂ